ਸਾਲਾਂ ਦੌਰਾਨ ਭਾਰਤੀ ਮਨੋਰੰਜਨ ਦਾ ਉਦਯੋਗ ਅਤੇ ਵਿਕਾਸ ਇਸ ਕਰਕੇ ਹੈ ਪਹਿਲੇ ਤਾਂ ਲੋਕ ਪੁਰਾਣੇ ਲੋਕ ਟੀ ਵੀ 'ਤੇ ਚੈਨਲ ਦੇਖਦੇ ਸਨ ਬਲੈਕ ਐਂਡ ਵਾਈਟ ਚੈਨਲ ਦੇਖਦੇ ਸਨ ਪਰ ਹੁਣ ਨਵੀਂ ਟੈਕਨੋਲੋਜੀ ਕਰਕੇ ਲੋਕ ਟੀ ਵੀ 'ਤੇ ਰੰਗ ਬਿਰੰਗੇ ਚੈਨਲ ਦੇਖ ਸਕਦੇ ਹਨ ਤਾਂ ਜੋ ਆਪਣਾ ਮਨੋਰੰਜਨ ਕਰ ਸਕਣ ਹੁਣ ਤਾਂ ਹੁਣ ਪਹਿਲੇ ਤਾਂ ਇੰਟਰਨੈਟ ਦੀ ਵੀ ਦਿੱਕਤ ਹੁੰਦੀ ਸੀ ਪਰ ਹੁਣ ਤਾਂ ਇੰਟਰਨੈਟ ਕਾਰਨ ਮੋਬਾਇਲ ਵਿੱਚ ਵੀ ਲੋਕ ਆਪਣਾ ਮਨੋਰੰਜਨ ਕਰ ਸਕਦੇ ਹਨ ਛੋਟੇ ਛੋਟੇ ਸ਼ੋਟਸ ਦੇਖ ਕੇ ਆਪਣਾ ਮ ਮਨੋਰੰਜਨ ਕਰ ਸਕਦੇ ਹਨ ਤੇ ਅਤੇ ਦੇਸ਼ ਦੇ ਮਨੋਰੰਜਨ ਦੇ ਸਭ ਤੋਂ ਮਨੋਰੰਜਨ ਕਰ ਸਕਦੇ ਹਨ ਭਾਰਤ ਵਿੱਚ ਲੋਕ ਧਾਰਮਿਕ ਚੈਨਲ ਦੇਖਣਾ ਪਸੰਦ ਕਰਦੇ ਹਨ ਤਾਂ ਜੋ ਉਹਨਾਂ ਵਿੱਚ ਹਿੰਮਤ ਅਤੇ ਹੌਸਲਾ ਅਤੇ ਸਬਰ ਸੰਤੋਖ ਆ ਸਕੇ ਉਹ ਆਪਣੇ ਮਨੋਰੰਜਨ ਦੇ ਕਾਰਨ ਦੇ ਮਨੋਰੰਜਨ ਦੇ ਚੈਨਲ ਦੇਖਦੇ ਹਨ ਫਿਰ ਉਹ ਸਪੋਰਟਸ ਦੇ ਚੈਨਲ ਦੇਖਦੇ ਹਨ ਤਾਂ ਜੋ ਉਹਨਾਂ ਵਿੱਚ ਖੇਡਣ ਦੀ ਸ਼ਕਤੀ ਵੱਧ ਸਕੇ ਹਿੰਮਤ ਅਤੇ ਹੌਸਲਾ ਆਵੇ ਫਿਰ ਉਹ ਧਾਰਮਿਕ ਚੈਨਲ ਨੂੰ ਸਭ ਤੋਂ ਪ੍ਰੇਰਿਤ ਦਿੰਦੇ ਹਨ ਪ੍ਰੈਫਰੈਂਸ ਦਿੰਦੇ ਹਨ ਕਿ ਉਹ ਸਭ ਤੋਂ ਪਹਿਲੇ ਉਹ ਧਾਰਮਿਕ ਚੈਨਲ ਦੇਖਦੇ ਆ ਕਿਉਂਕਿ ਪੰਜਾਬ ਦੇ ਲੋਕ ਗੁਰਬਾਣੀ ਅਤੇ ਹੋਰ ਚੀਜ਼ਾਂ ਨੂੰ ਬਹੁਤ ਪਸੰਦ ਕਰਦੇ ਹਨ ਕਿਉਂਕਿ ਇਹ ਸਾਡੇ ਗੁਰੂਆਂ ਅਤੇ ਪੀਰਾਂ ਗੁਰੂਆਂ ਅਤੇ ਗੁਰੂਆਂ ਨੇ ਪੰਜਾਬੀ ਦੀ ਵਿਸ਼ੇਸ਼ਤਾ ਕੀਤੀ ਹੈ ਤਾਂ ਜੋ ਆਪਾਂ ਗੁਰਬਾਣੀ ਪੜ੍ਹ ਸਕੀਏ ਅਤੇ ਆਪਣੇ ਵਿੱਚ ਸਬਰ ਸੰਤੋਖ ਪਾ ਪ੍ਰਾਪਤ ਕਰ ਸਕੀਏ ਪਰ ਪਹਿਲਾਂ ਤਾਂ ਹੁਣ ਤਾਂ ਖਾਣੇ ਵਿੱਚ ਪਹਿਲਾਂ ਤਾਂ ਲੋਕ ਖਾਣੇ ਵਿੱਚ ਸਾਗ ਪਿੰਡਾਂ ਦੇ ਲੋਕ ਸਾਗ ਮੱਕੀ ਦੀ ਰੋਟੀ ਸ਼ਹਿਰਾਂ ਵਿੱਚ ਵੀ ਕਈ ਕਰਦੇ ਹਨ ਪਰ ਪਿੰਡਾਂ ਦੇ ਲੋਕ ਵਿੱਚ ਪਹਿਲਾਂ ਪਹਿਲਾਂ ਸਾਗ ਮ ਮੱਕੀ ਦੀ ਰੋਟੀ ਇਹ ਸਭ ਕੁਛ ਚਲਦਾ ਹੁੰਦਾ ਸੀ ਘਿਉ ਦੇ ਦੇਸੀ ਘਿਉ ਪਹਿਲੇ ਦੇ ਭਲ ਭਲਵਾਨ ਪਿੰਡਾਂ ਦੇ ਭਲਵਾਨ ਦੇਸੀ ਘਿਉ ਦੇ ਬਾਟੇ ਰੁੱਖੇ ਹੀ ਖਾ ਜਾਂਦੇ ਸਨ ਪਰ ਹੁਣ ਤਾਂ ਜਦੋਂ ਜਦੋਂ ਜ਼ਮਾਨਾ ਚਲਦਾ ਪਿਆ ਹੈ ਤਾਂ ਜੋ ਸ਼ਹਿਰਾਂ ਦੇ ਲੋਕ ਹੁਣ ਤਾਂ ਫਾਸਟ ਫੂਡ ਖਾਣ ਲੱਗ ਪਏ ਹਨ ਤਾਂ ਜੋ ਉਹ ਬੱਚੇ ਬਿਮਾਰ ਹੋ ਸਕਣ ਬ ਬੱਚੇ ਬਿਮਾਰ ਹੋ ਜਾਂਦੇ ਹਨ ਇਸ ਲਈ ਸਾਨੂੰ ਇਹ ਖਾਣਾ ਨਹੀਂ ਖਾਣਾ ਚਾਹੀਦਾ ਕਿਉਂਕਿ ਸਾਨੂੰ ਪੰਜਾਬ ਦੀ ਸ਼ਾਨ ਨੂੰ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਉਹ ਸਾਨੂੰ ਹਮੇਸ਼ਾ ਸਾਗ ਦਾਲ ਫੁਲਕਾ ਰੋਟੀ ਜਿਹਦੇ ਵਿੱਚ ਸਾਨੂੰ ਬਹੁਤ ਹੀ ਸ਼ਕਤੀ ਅਤੇ ਪ੍ਰਾਪਤ ਹੁੰਦੀ ਹੈ ਇਸ ਲਈ ਸਾਨੂੰ ਹਮੇਸ਼ਾ ਸਾਗ ਫੁਲਕਾ ਦਾਲ ਅਤੇ ਦੇਸੀ ਘਿਉ ਜ਼ਰੂਰ ਖਾਣਾ ਚਾਹੀਦਾ